ਅਸੀਂ ਬਾਗ ਵਿੱਚ ਉੱਗੇ ਫੁੱਲਾਂ ਫੁੱਲਾਂ ਨੂੰ ਅਸੀਂ ਬਾਹਰ ਆਪਣਾ ਵੇਚ ਕੇ ਵੀ ਆਉਂਦੇ ਹਾਂ ਤਾਂ ਜੋ ਸਾਨੂੰ ਸਾਡੇ ਨਾਲ ਸਾਨੂੰ ਉਹਨਾਂ ਦੀ ਕਮਾਈ ਹੋ ਸਕੇ ਅਤੇ ਅਸੀਂ ਜੋ ਫੁੱਲ ਆਪਣਾ ਘਰੇ ਲਾਏ ਹੋਏ ਆ ਉਹਨਾਂ ਨਾਲ ਸਾਨੂੰ ਆਪਣਾ ਘਰ ਦੀ ਦੇਖੀ ਵਧੀਆ ਲੱਗਦੀ ਹੈ ਜੇ ਕੋਈ ਆਉਂਦਾ ਉਹਨਾਂ ਨੂੰ ਵੀ ਵਧੀਆ ਲੱਗਦਾ ਹੈ ਅਤੇ ਇਸ ਨਾਲ ਸਾਡੀ ਅੱਖਾਂ ਵੀ ਤਰੋ ਤਾ ਤਰੋ ਤਾਜ਼ਾ ਹੁੰਦੀਆਂ ਅਤੇ ਜਿਹੜਾ ਫਲ ਹੈ ਫਲਾਂ ਨੂੰ ਫਲਾਂ ਨੂੰ ਅਸੀਂ ਐਕਸਪੋਰਟ ਵੀ ਕਰਦੇ ਹਾਂ ਫਲ ਆਪਣਾ ਸਾਡੇ ਘਰ ਵਿੱਚ ਵੀ ਖਾਣ ਨੂੰ ਸਾਰੇ ਪਰਿਵਾਰ ਖਾਂਦਾ ਤਾਂ ਜੋ ਵਧੀਆ ਇਹਨਾਂ ਤੋਂ ਬ ਬਿਮਾਰੀਆਂ ਤੋਂ ਬਚਿਆ ਜਾ ਸਕੇ ਅਤੇ ਜੇ ਅਸੀਂ ਆਪਾਂ ਕਿਸੇ ਰਿਸ਼ਤੇਦਾਰੀ 'ਚ ਜਾਂਦੇ ਹਾਂ ਅਤੇ ਫਲ ਅਸੀਂ ਉਹਨਾਂ ਨੂੰ ਦੇ ਕੇ ਵੀ ਆਉਂਦੇ ਹਾਂ ਅਤੇ ਉੱਧਰੋਂ ਆਪਾਂ ਅਸੀਂ ਲੈ ਕੇ ਵੀ ਆਉਂਦੇ ਹਾਂ ਫਲ ਜੇ ਕੋਈ ਸਾਨੂੰ ਆਪਣਾ ਦਿੰਦਾ ਫਲ ਅਤੇ ਇਸ ਨਾਲ ਅਸੀਂ ਅੱਗੇ ਕਮਾਈ ਕਰਦੇ ਹਾਂ ਅਤੇ ਫਲਾਂ ਨਾਲ ਬਹੁਤ ਜ਼ਿਆਦਾ ਆਪਣਾ ਬਿਮਾਰੀਆਂ ਤੋਂ ਬਚਿਆ ਜਾਂਦਾ ਸਾਨੂੰ